ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਨੇ ਕੁੜੀਆਂ ਦੇ ਲੜਕੀਆਂ ਦੇ ਸਿੱਖਿਆ ਦੇ ਉੱਤੇ ਜਿਹੜੇ ਜਿਹੜੇ ਕੰਮ ਕੀਤੇ ਜਿਹੜੇ ਮੈਨੂੰ ਯਾਦ ਆ ਰਹੇ ਨੇ ਜੀ ਉਹ ਤਾਂ ਜਿਵੇਂ ਇੱਕ ਸਰਕਾਰ ਆਈ ਸੀ ਜਿਨ੍ਹਾਂ ਨੇ ਕੁੜੀਆਂ ਨੂੰ ਲੜਕੀਆਂ ਨੂੰ ਜਿਹੜੀ ਹੈਗੀ ਸਕੂਲਾਂ ਵਿੱਚ ਉਹਨਾਂ ਨੂੰ ਉਹਨਾਂ ਸਾਈਕਲਾਂ ਜਿਹੜੀ ਹੈਗੀ ਉਹ ਵੰਡੀ ਸੀਗੀ ਅਤੇ ਦੂਜੀ ਚੀਜ਼ ਆਹ ਹੋ ਗਈ ਵੀ ਜਿਹੜੀ ਮੈਨੂੰ ਯਾਦ ਆ ਰਹੀ ਹੈ ਇੱਕ ਵਾਰੀ ਸਮਾਰਟਫੋਨ ਵੀ ਦਿੱਤੇ ਗਏ ਸੀ ਅਤੇ ਤੀਜੀ ਚੀਜ਼ ਜਿਹੜੇ ਸਰਕਾਰੀ ਸਕੂਲ ਹੈਗੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਕੁੜੀਆਂ ਦੀ ਕੋਈ ਫੀਸ ਹੈ ਨਹੀਂ ਸੀ ਹੈ ਵੀ ਹੈ ਹੀ ਨਹੀਂ ਉਹ ਖਤਮ ਕੀਤੀ ਹੋਈ ਹੈ ਅਤੇ ਫਰੀ ਉਹਨਾਂ ਦਾ ਪੜ੍ਹਨਾ ਅਤੇ ਉਹ ਮਿਡ ਡੇ ਮੀਲ ਵੀ ਉੱਥੇ ਮਿਲਦਾ ਇਹ ਜਿਹੜੀ ਚੀਜ਼ ਹੋ ਗਈ ਅਤੇ ਜਿਹੜੀ ਉਹਨੂੰ ਕਿਤਾਬਾਂ ਹੈਗੀ ਉਹ ਵੀ ਮਿਲਦੀ ਹੈ ਅਤੇ ਉਹਦਾ ਟਰਾਂਸਪੋਰਟ ਵੀ ਅਤੇ ਇਹ ਜਿਹੜੀਆਂ ਚੀਜ਼ਾਂ ਜਿਹੜੀ ਗਰਲਸ ਜਾਂ ਕੁੜੀਆਂ ਦੀ ਸ਼ਿਕਸ਼ਾ ਨੂੰ ਲੜਕੀਆਂ ਦੀ ਸਿੱਖਿਆ ਨੂੰ ਪ੍ਰਮੋਟ ਕਰਨ ਦੇ ਲਈ ਸਰਕਾਰ ਕੋਸ਼ਿਸ਼ ਕਰ ਰਹੀ ਹੈ ਅਤੇ ਉਹਨੂੰ ਅੱਗੇ ਵੀ ਵੱਧ ਤੋਂ ਵੱਧ ਵਧਾਉਣ ਵਧਾਉਣ ਦੀ ਲੋੜ ਹੈਗੀ ਜੀ ਧੰਨਵਾਦ